ਮੇਰੇ ਮਨਭਾਉਂਦੇ ਲੇਖਕਾਂ ਕਵੀਆਂ ਅਤੇ ਨਾਵਲਕਾਰਾਂ ਵਿੱਚੋਂ ਸਭ ਤੋਂ ਵੱਧ ਮਨਭਾਉਂਦਾ ਕਵੀ ਲੇਖਕ ਅਤੇ ਨਾਵਲਕਾਰ ਬਲਵੰਤ ਗਾਰਗੀ ਹੈ ਬਲਵੰਤ ਗਾਰਗੀ ਦੀਆਂ ਮੈਂ ਬਹੁਤ ਜ਼ਿਆਦਾ ਕਿਤਾਬਾਂ ਪੜ੍ਹੀਆਂ ਹਨ ਜਿਨ੍ਹਾਂ ਵਿੱਚੋਂ ਕੁਛ ਕਿਤਾਬਾਂ ਦੇ ਨਾਮ ਮੈਨੂੰ ਯਾਦ ਵੀ ਹਨ ਕਣਕ ਦੀ ਬੱਲੀ ਬਲਵੰਤ ਗਾਰਗੀ ਦੀਆਂ ਕਹਾਣੀਆਂ ਪੈਂਤੜੇਬਾਜ਼ ਕਿਤਾਬ ਮਿਰਜ਼ਾ ਸਾਹਿਬਾਂ ਜੂਠੀ ਰੋਟੀ ਹਸੀਨ ਚਿਹਰੇ ਅਤੇ ਕੱਕਾ ਰੇਤਾ ਅਤੇ ਸਵੈ ਜੀਵਨੀ ਸਵੈ ਜੀਵਨੀਆਂ ਵਿੱਚੋਂ ਸਭ ਤੋਂ ਵੱਧ ਮਨਭਾਉਂਦੀ ਮੇਰੀ ਕਿਤਾਬ ਹੈ ਨੰਗੀ ਧੁੱਪ ਨੰਗੀ ਧੁੱਪ ਦੇ ਵਿੱਚ ਬਲਵੰਤ ਬਲਵੰਤ ਗਾਰਗੀ ਨੇ ਆਪਣੇ ਸਵੈ ਜੀਵਨ ਬਾਰੇ ਲਿਖਿਆ ਹੈ ਜਿਸ ਵਿੱਚ ਪਹਿਲੇ ਪੇਜ 'ਤੇ ਪੜ੍ਹਨ ਨੂੰ ਮਿਲਦਾ ਹੈ ਜਦੋਂ ਮੈਂ ਲੰਡਨ ਵਿੱਚ ਰਹਿ ਰਿਹਾ ਸੀ ਉਸ ਟਾਈਮ ਮੇਰੇ ਤਿੰਨ ਪਿਆਰ ਰਹੇ ਚੱਲ ਰਹੇ ਸਨ ਪਰ ਮੈਨੂੰ ਇਹ ਨਹੀਂ ਸਮਝ ਆ ਰਿਹਾ ਸੀ ਕਿ ਮੈਂ ਤਿੰਨਾਂ ਕੁੜੀਆਂ ਦੇ ਵਿੱਚੋਂ ਕਿਸ ਨੂੰ ਚੁਣਾ ਅਤੇ ਕਿਸ ਨੂੰ ਛੱਡਾਂ ਤਿੰਨੋਂ ਹੀ ਮੇਰੇ ਉੱਤੋਂ ਜਾਨ ਛਿੜਕਦੀਆਂ ਸਨ ਇਸ ਤੋਂ ਇਲਾਵਾ ਬਲਵੰਤ ਗਾਰਗੀ ਨੇ ਆਪਣੀ ਹਰ ਇੱਕ ਕਿਤਾਬ ਦੇ ਵਿੱਚ ਜ਼ਿਆਦਾਤਰ ਇਸ਼ਕ ਮਿਜ਼ਾਜ ਬਾਰੇ ਲਿਖਿਆ ਹੈ ਅਤੇ ਪਿਆਰ ਨੂੰ ਹੀ ਸਭ ਤੋਂ ਵੱਧ ਮਹੱਤਵਪੂਰਨ ਵਿਸ਼ਾ ਮੰਨ ਕੇ ਉਸ 'ਤੇ ਵੱਧ ਟੋਪਿਕ ਲਿਖੀਆਂ ਹੋਈਆਂ ਕਿਤਾਬਾਂ ਪੜ੍ਹਨ ਨੂੰ ਮਿਲਦੀਆਂ ਹਨ ਇਸ ਕਰਕੇ ਮੇਰਾ ਸਭ ਤੋਂ ਮਨਭਾਉਂਦਾ ਕਵੀ ਬਲਵੰਤ ਗਾਰਗੀ ਹੈ